ਮੇਰੇ ਪਤੀ ਔਨਲਾਈਨ ਕੰਮ ਕਰਦੇ ਹਨ ਔਨਲਾਈਨ ਹੀ ਉਨ੍ਹਾਂ ਦਾ ਸਾਰਾ ਲੈਣ ਦੇਣ ਹੁੰਦਾ ਹੈ ਇਸੇ ਕੰਮ ਦੇ ਚਲਦੇ ਉਨ੍ਹਾਂ ਨੂੰ ਇੱਕ ਪ੍ਰੋਮੋ ਕੋਡ ਮਿਲਿਆ ਪ੍ਰੋਮੋ ਕੋਡ ਕੈਸ਼ਬੈਕ ਮਿਲਿਆ ਹੈ ਜੋ ਪੰ ਜੋ ਕਿ ਪੰਜ ਹਜ਼ਾਰ ਰੁਪਏ ਦਾ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਲੈਪਟੋਪ ਖਰੀਦੋਗੇ ਤਾਂ ਤੁਹਾਨੂੰ ਪੰਜ ਹ ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲੇਗਾ ਵੈਸੇ ਵੀ ਥੋੜ੍ਹੇ ਦਿਨਾਂ ਤੋਂ ਮੇਰਾ ਬੱਚਾ ਲੈਪਟੋਪ ਦੀ ਜਿੱਦ ਕਰ ਰਿਹਾ ਸੀ ਅਤੇ ਫਿਰ ਅਸੀਂ ਸੋਚਿਆ ਕਿ ਸਾਨੂੰ ਲੈਪਟੋਪ ਲੈ ਲੈਣਾ ਚਾਹੀਦਾ ਹੈ ਅਤੇ ਜਦੋਂ ਅਸੀਂ ਫਿਰ ਲੈਪਟੋਪ ਲੈਣ ਲੱਗੇ ਤਾਂ ਫਿਰ ਸਾਨੂੰ ਸਾਡਾ ਲੈਪਟੋਪ ਸੱਠ ਹਜ਼ਾਰ ਰੁਪਏ ਦਾ ਸੀ ਅਤੇ ਫਿਰ ਅਸੀਂ ਆਪਣਾ ਪ੍ਰੋਮੋ ਕੋਡ ਵਰਤਿਆ ਅਤੇ ਸਾਨੂੰ ਉਹੀ ਲੈਪਟੋਪ ਪਚਵੰਜਾ ਹਜ਼ਾਰ ਰੁਪਏ ਦਾ ਲੱਗ ਗਿਆ ਇਸ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਹਾਂਜੀ ਕੈਸ਼ਬੈਕ ਮਿਲਨ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਲੈਪਟੋਪ ਸੱਠ ਹਜ਼ਾਰ ਦਾ ਸੀ ਜੋ ਕਿ ਪ੍ਰੋਮੋ ਕੋਡ ਦੀ ਵਜ੍ਹਾ ਨਾਲ ਸਾਨੂੰ ਪਚਵੰਜਾ ਹਜ਼ਾਰ ਰੁਪਏ ਦਾ ਮਿਲ ਗਿਆ ਇਸ ਨਾਲ ਮੇਰਾ ਬੱਚਾ ਵੀ ਬਹੁਤ ਖੁਸ਼ ਹੋ ਗਿਆ ਅਤੇ ਸਾਡਾ ਕੰਮ ਵੀ ਹੁਣ ਵਧੀਆ ਤਰੀਕੇ ਨਾਲ ਅਤੇ ਜਲਦੀ ਹੋ ਜਾਇਆ ਕਰੇਗਾ